ਭੰਗੜਾ ਪੰਜਾਬ ਦਾ ਲੋਕ ਨਾਚ ਹੈ ਇਸ ਇਹ ਪੰਜਾਬ ਹੀ ਨਹੀਂ ਸਗੋਂ ਦੇਸ਼ ਅਤੇ ਦੁਨੀਆਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ਜਿੱਥੇ ਵੀ ਪੰਜਾਬੀ ਰਹਿੰਦੇ ਹਨ ਉਹ ਭੰਗੜਾ ਬਹੁਤ ਵਧੀਆ ਕਰਦੇ ਪਾਉਂਦੇ ਹਨ ਅਤੇ ਇਹ ਬਹੁਤ ਸੋਹਣਾ ਲੋਕ ਨਾਚ ਹੈ ਇਹ ਦਿਵਾਲੀ ਤਿਉਹਾਰ ਵਿਆਹ ਸ਼ਾਦੀਆਂ ਅਤੇ ਹੋਰ ਵੀ ਕਈ ਖੁਸ਼ੀ ਦੇ ਮੌਕਿਆਂ 'ਤੇ ਪਾਇਆ ਜਾਣ ਵਾਲਾ ਨਾਚ ਹੈ ਇਸ ਦੀ ਮਹੱਤਤਾ ਇਹ ਹੈ ਕਿ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਵਿਰਾਸਤ ਵਿੱਚੋਂ ਮਿਲਾ ਹੋਇਆ ਨਾਚ ਹੈ ਇਹ ਬਹੁਤ ਮੁੰਡਿਆਂ ਅਤੇ ਕੁੜੀਆਂ ਵੱਲੋਂ ਪਾਇਆ ਜਾਂਦਾ ਹੈ ਇਹਦੇ ਵਿੱਚ ਲੋਕ ਸਰਦਾਰ ਪੱਗਾਂ ਸਜਾ ਕੇ ਅਤੇ ਲੁੰਗੀਆਂ ਬੰਨ ਕੇ ਭੰਗੜਾ ਕਰਦੇ ਹਨ ਇਹ ਜ਼ਿਆਦਾ ਤੋਂ ਜ਼ਿਆਦਾ ਪੰਜ ਸੱਤ ਸੋਂਗ 'ਤੇ ਕੀਤਾ ਜਾਂਦਾ ਹੈ ਇਸ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਅਤੇ ਉਤਸ਼ਾਹ ਨਾਲ ਪਾਇਆ ਜਾਂਦਾ ਹੈ ਇਸ ਨੂੰ ਕਰਨ ਵਿੱਚ ਇਹ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ਇਸ ਲਈ ਇਹ ਪੰਜਾਬੀਆਂ ਦਾ ਮੁੱਖ ਨਾਚ ਮੰਨਿਆ ਜਾਂਦਾ ਹੈ ਇਸ ਵਿੱਚ ਸਰਦਾਰ ਪੱਗਾਂ ਸੋਹਣੀਆਂ ਬੰਨ ਕੇ ਚਾਦਰੇ ਬੰਨ ਕੇ ਅਤੇ ਕੈਂਠੇ ਗਲ ਵਿੱਚ ਪਾ ਕੇ ਮੇਲੇ ਤਿਉਹਾਰਾਂ ਵਿੱਚ ਭੰਗੜਾ ਪਾਉਂਦੇ ਆਮ ਦਿਸ ਦੇ ਹਨ ਸਾਡੇ ਇੱਕ ਕਾਲਜ ਵਿੱਚ ਫੰਕਸ਼ਨ ਹੋਇਆ ਸੀ ਦੀਵਾਲੀ ਦੇ ਮੌਕੇ 'ਤੇ ਜਿ ਜਿਸ ਵਿੱਚ ਕੁਝ ਮੁੰਡੇ ਅਤੇ ਕੁੜੀਆਂ ਵੱਲੋਂ ਭੰਗੜਾ ਕੀਤਾ ਗਿਆ ਉਹ ਅਸੀਂ ਵੇਖਣ ਗਏ ਸੀ ਬਹੁਤ ਹੀ ਜ਼ਿਆਦਾ ਵਧੀਆ ਉਹਨਾਂ ਨੇ ਭੰਗੜਾ ਕੀਤਾ ਬਹੁਤ ਜ਼ਿਆਦਾ ਕੀਤਾ ਭੰਗੜਾ ਦੁਨੀਆਂ ਵਿੱਚ ਪੰਜਾਬ ਹੀ ਨਹੀਂ ਦੁਨੀਆਂ ਵਿੱਚ ਵੀ ਪ੍ਰਚਲਿਤ ਹੈ ਇਸ ਨੂੰ ਬੜੀ ਚਾਅ ਅਤੇ ਖੁਸ਼ੀ ਨਾਲ ਪਾਇਆ ਜਾਂਦਾ ਹੈ